ਅੰਮ੍ਰਿਤਸਰ ਦੇ ਨੇੜੇ ਜੀ ਜੋ ਦੁਨੀਆਂ ਆਉਂਦੀ ਹੈ ਅਤੇ ਦੇਖਣਾ ਚਾਹੁੰਦੀ ਹੈ ਉਹ ਹੈ ਵਾਹਗਾ ਬੋਡਰ ਅਤੇ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਹਰਿਮੰਦਰ ਸਾਹਿਬ ਅਤੇ ਵਾਹਗਾ ਬੋਡਰ ਦੇ ਵਿੱਚ ਜਿਹੜੀਆਂ ਚੀਜ਼ਾਂ ਆਉਂਦੀਆਂ ਨੇ ਉਹ ਹੈ ਜੀ ਗੋਬਿੰਦਗੜ੍ਹ ਕਿਲ੍ਹਾ ਜੋ ਮਹਾਰਾਜਾ ਰਣਜੀਤ ਸਿੰਘ ਦਾ ਹੈ ਇੱਕ ਵੈਸ਼ਨੋ ਮੰਦਿਰ ਹੈ ਜੀ ਜੋ ਮਾਡਲ ਟਾਊਨ 'ਤੇ ਹੈ ਜ਼ਿਆਦਾ ਲੋਕ ਜੋ ਦੇਖਣ ਆਉਂਦੇ ਨੇ ਉਹ ਹਰਿਮੰਦਰ ਸਾਹਿਬ ਅਤੇ ਵਾਹਗਾ ਬੋਡਰ ਹੈ ਮੈਂ ਆਪ ਇੱਕ ਟੂਰਿਸਟ ਗਾਈਡ ਹਾਂ ਮੈਂ ਟੈਕਸੀ ਵੀ ਦਿੰਦਾ ਹਾਂ ਅਤੇ ਆਪ ਵੀ ਚਲਾਉਂਦਾ ਹਾਂ ਟੈਕਸੀ ਜਦੋਂ ਅਸੀਂ ਲੈ ਕੇ ਜਾਂਦੇ ਹਾਂ ਉਹਨਾਂ ਨੂੰ ਜੇ ਤਾਂ ਸਵੇਰੇ ਅਸੀਂ ਦਸ ਵਜੇ ਚੁੱਕੀਏ ਦਸ ਵਜੇ ਚੁੱਕੀਏ ਅਤੇ ਦਰਬਾਰ ਸਾਹਿਬ ਲੈ ਕੇ ਆਈਏ ਅਤੇ ਦੁਪਹਿਰ ਤੱਕ ਉਹ ਦਰਬਾਰ ਸਾਹਿਬ ਦੇਖਦੇ ਨੇ ਕੋਲ ਜਲ੍ਹਿਆਂਵਾਲਾ ਬਾਗ ਹੈ ਪਾਰਟੀਸ਼ੀਅਨ ਮਿਊਜ਼ੀਅਮ ਹੈ ਉਸ ਤੋਂ ਬਾਅਦ ਉਹਨਾਂ ਨੂੰ ਜੇ ਅਸੀਂ ਬੋਡਰ 'ਤੇ ਲੈ ਕੇ ਜਾਂਦੇ ਹਾਂ ਅਤੇ ਵਾਪਸ ਉਹਨਾਂ ਨੂੰ ਹੋਟਲ ਛੱਡਦੇ ਹਾਂ ਜਾਂ ਸਟੇਸ਼ਨ 'ਤੇ ਛੱਡਦੇ ਹਾਂ ਉਹਦਾ ਜੋ ਖਰਚਾ ਆਉਂਦਾ ਉਹ ਆਉਂਦਾ ਜੀ ਅਠਾਰਾਂ ਸੌ ਰੁਪਏ ਬਾਕੀ ਜੇ ਅਸੀਂ ਸਿਰਫ਼ ਉਹਨਾਂ ਨੂੰ ਦਰਬਾਰ ਸਾਹਿਬ ਤੋਂ ਦੋ ਵਜੇ ਢਾਈ ਵਜੇ ਚੁੱਕਦੇ ਹਾਂ ਅਤੇ ਵਾਹਗਾ ਬੋਡਰ ਲੈ ਕੇ ਜਾਂਦੇ ਹਾਂ ਅਤੇ ਵਾਪਸ ਆਉਂਦੇ ਹਾਂ ਉਹਦਾ ਖਰਚਾ ਆਉਂਦਾ ਜੀ ਪੰਦਰਾਂ ਸੌ ਰੁਪਏ ਅੰਮ੍ਰਿਤਸਰ ਦੇ ਨੇੜੇ ਹੋਰ ਵੀ ਬੜੀਆਂ ਚੀਜ਼ਾਂ ਨੇ ਜਿਵੇਂ ਕਿ ਗੁਰਦੁਆਰੇ ਲੋਕ ਬਹੁਤ ਜਾਂਦੇ ਨੇ ਅਤੇ ਇੱਥੇ ਕਾਫ਼ੀ ਇਤਿਹਾਸਿਕ ਗੁਰਦੁਆਰੇ ਹਨ ਜਿਵੇਂ ਕਿ ਤਰਨਤਾਰਨ ਸਾਹਿਬ ਗੋਇੰਦਵਾਲ ਸਾਹਿਬ ਟਾਹਲਾ ਸਾਹਿਬ ਝੂਲਨਾ ਮਹਿਲ ਇਹਨਾਂ ਥਾਵਾਂ 'ਤੇ ਜਾਣ ਲਈ ਇੱਕ ਦਿਨ ਵੱਖਰਾ ਲੱਗਦਾ ਹੈ ਜੀ